ਤਿਉਹਾਰਾਂ ਲਈ ਧਾਰਮਿਕ ਮੌਕਿਆਂ ਦੇਵਤਿਆਂ ਦੀ ਮੂਰਤੀਆਂ ਬਣਾਈਆਂ ਬਣਾਈਆਂ ਬੜੇ ਸ਼ਹਿਰਾਂ ਵਿੱਚ ਬਣਾਈਆਂ ਜਾਂਦੀਆਂ ਹਨ ਜਿੱਦਾਂ ਕਿ ਸਕੂਲਾਂ ਵਿੱਚ ਕਈ ਪ੍ਰਕਾਰ ਦੇ ਕੋਂਪੀਟੀਸ਼ਨ ਚੱਲਦੇ ਹਨ ਜਿੱਦਾਂ ਕਿ ਦਿਵਾਲੀ 'ਤੇ ਅਸੀਂ ਸਕੂਲਾਂ ਵਿੱਚ ਘਰਾਂ ਵਿੱਚ ਰੰਗੋਲੀ ਬਣਾਉਂਦੇ ਹਨ ਪਿਛਲੀ ਵਾਰ ਅਸੀਂ ਸਕੂਲ ਵਿੱਚ ਇੱਕ ਕੋਂਪੀਟੀਸ਼ਨ ਵਿੱਚ ਇੱਕ ਗਣੇਸ਼ ਜੀ ਦੀ ਮੂਰਤੀ ਬਣਾਈ ਸੀ ਕਲੇਅ ਦੇ ਨਾਲ ਜੋ ਕਿ ਬਹੁਤ ਵਧੀਆ ਬਣੀ ਸਾਰਿਆਂ ਨੇ ਉਸ ਮੂਰਤੀ ਨੂੰ ਬਹੁਤ ਪਸੰਦ ਕੀਤਾ ਅਸੀਂ ਘਰਾਂ ਵਿੱਚ ਵੀ ਰੰਗੋਲੀ ਹਰ ਪ੍ਰਕਾਰ ਦੀ ਬਣਾਉਂਦੇ ਹਨ ਕੋਈ ਗਾਏ ਗਣਪਤੀ ਜੀ ਛੋਟੇ ਜਿਹੇ ਬਣਾਉਂਦੇ ਹਨ ਜਿਸ ਦੀ ਕਿ ਅਸੀਂ ਫਿਰ ਰਾਤ ਨੂੰ ਪੂਜਾ ਕਰਦੇ ਹਾਂ ਹਰ ਪ੍ਰਕਾਰ ਦੀ ਡਰਾਇੰਗ ਅਸੀਂ ਸਕੂਲਾਂ ਵਿੱਚ ਕਰਦੇ ਹਾਂ ਹਰ ਸਰ ਅੱਜ ਕੱਲ੍ਹ ਤਾਂ ਹਰ ਸਕੂਲਾਂ ਵਿੱਚ ਹਰ ਪ੍ਰਕਾਰ ਦੇ ਕੋਂਪੀਟੀਸ਼ਨ ਚੱਲ ਰਹੇ ਹਨ ਜਿਸ ਵਿੱਚ ਅਸੀਂ ਹਰ ਪ੍ਰਕਾਰ ਦੀ ਡਰਾਇੰਗ ਬਣਾਉਂਦੇ ਹਨ ਜਿੱਦਾਂ ਮੂਰਤੀਆਂ ਬਣਾ ਕੇ ਜਾਂ ਕੋਈ ਸਟੈਚੂ ਬਣਾ ਕੇ ਕੋਈ ਕਿਸੇ ਪ੍ਰਕਾਰ ਦੇ ਤਸਵੀਰ ਬਣਾਉਂਦੇ ਹਨ ਜੋ ਕਿ ਅ ਜਿੱਦਾਂ ਕਿ ਅਸੀਂ ਘਰਾਂ ਵਿੱਚ ਵੀ ਹੁਣ ਦਿਨ ਤਿਉਹਾਰ 'ਤੇ ਅਸੀਂ ਤਾਂ ਹਰ ਤਿਉਹਾਰ 'ਤੇ ਅੱਜ ਕੱਲ੍ਹ ਜਿੱਦਾਂ ਰੰਗੋਲੀ ਬਣਾ ਰਹੇ ਹਾਂ ਕਿਤੇ ਅਸੀਂ ਸਜਾਵਟ ਕਰ ਰਹੇ ਕਿਤੇ ਅਸੀਂ ਫੁੱਲਾਂ ਨਾਲ ਡੈਕੋਰੇਸ਼ਨ ਕਰਦੇ ਹਾਂ ਹਰ ਪ੍ਰਕਾਰ ਦੀ ਡੈਕੋਰੇਸ਼ਨ ਨੂੰ ਅਸੀਂ ਆਪਣੇ ਘਰਾਂ ਵਿੱਚ ਵੀ ਕਰਨਾ ਪਸੰਦ ਕਰਦੇ ਹਾਂ ਛੋਟੀਆਂ ਛੋਟੀਆਂ ਮੂਰਤੀਆਂ ਬਣਾ ਕੇ ਉਹਨਾਂ ਨੂੰ ਫਿਰ ਅਸੀਂ ਬਾਅਦ ਵਿੱਚ ਉਹਨਾਂ ਦੀ ਪੂਜਾ ਕਰਦੇ ਹਾਂ ਜ ਗਣਪਤੀ ਜੀ ਦੀ ਮੂਰਤੀ ਹੋ ਗਈ ਜਾਂ ਅਸੀਂ ਮਾਂ ਲਕਸ਼ਮੀ ਜੀ ਦੀ ਛੋਟੇ ਜਿਹੇ ਉਹ ਚਰਨ ਬਣਾ ਕੇ ਅਸੀਂ ਉਹਨਾਂ ਦੀ ਵੀ ਮੂਰਤੀ ਕਰਦੇ ਹਨ ਸਕੂਲਾਂ ਵਿੱਚ ਵੀ ਅਸੀਂ ਹਰ ਕਈ ਪ੍ਰਕਾਰ ਦੀ ਡਰਾਇੰਗ ਬਣਾ ਕੇ ਅਸੀਂ ਕੋਂਪੀਟੀਸ਼ਨ ਵਿੱਚ ਵੀ ਹਿੱਸਾ ਲੈਂਦੇ ਹਾਂ ਤਾਂ ਜੋ ਕਿ ਸਾਨੂੰ ਵੀ ਪਤਾ ਲੱਗੇ ਕਿ ਅਤੇ ਕਿੱਦਾਂ ਮੂਰਤੀਆਂ ਬਣਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਡੈਕੋਰੇਸ਼ਨ ਕਰਕੇ ਸਾਰਿਆਂ ਨੂੰ ਦਿਖਾਉਂਦੇ ਹਾਂ ਜੋ ਕਿ ਆਨ ਸਭ ਨੂੰ ਬਹੁਤ ਪਸੰਦ ਆਉਂਦੀਆਂ ਹਨ ਰੰਗੋਲੀ ਵੀ ਅਸੀਂ ਇੱਕ ਦੋ ਵਾਰੀ ਬਣਾਈ ਹੈ ਜਿਸ ਕਰਕੇ ਕਿ ਅਸੀਂ ਬੜੀ ਵਧੀਆ ਲੋਕਾਂ ਨੂੰ ਵੀ ਬੜਾ ਪ੍ਰਭਾਵਿਤ ਹੋਈ ਹੈ